ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਦੱਸੋ

ਹਾਂਜੀ ਹਾਂਜੀ

ਹਾਂਜੀ ਹਮ

ਹਮ ਹਾਂਜੀ ਹਾਂਜੀ ਹਾਂਜੀ ਓਕੇ ਜੀ ਤੁਹਾਡੀ ਕੰਮਪਲੇਟ ਜ਼ਰੂਰ ਲਿਖੀ ਜਾਵੇਗੀ ਪੰਜਾਬ ਪੁਲਿਸ ਤੁਹਾਡੀ ਸੇਵਾ ਲਈ ਹਾਜ਼ਰ ਹੈ ਤੁਸੀਂ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ ਕਿ ਤੁਹਾਡਾ ਬੈਗ ਕਿਸ ਰੰਗ ਦਾ ਸੀ

ਹਾਂਜੀ ਅਤੇ ਉਹਦਾ ਮਤਲਬ ਕਿਵੇਂ ਦਾ ਬੈਗ ਸੀਗਾ ਹੈਂਡਬੈਗ ਸੀ ਟਰੋਲੀ ਬੈਗ ਸੀ ਹਾਂਜੀ ਕਾਲੇ ਰੰਗ ਦਾ ਅਤੇ ਉਹਦੇ 'ਚ ਤੁਹਾਡਾ ਕੋਈ ਕੀਮਤੀ ਸਮਾਨ ਜਾਂ ਪੈਸੇ ਵਗੈਰਾ ਹੈ ਸੀ ਹਾਂਜੀ ਹਾਂਜੀ ਅਤੇ ਤੁਸੀਂ ਕਿਹੜੇ ਰੇਲਵੇ ਸਟੇਸ਼ਨ 'ਤੇ ਸੀ ਉਸ ਟਾਈਮ ਅੱਛਾ ਜੀ ਜੀ ਅਸੀਂ ਤੁਹਾਡਾ ਬੈਗ ਹੈ ਜਿਹੜਾ ਉਹ ਜ਼ਿਆਦਾ ਤੋਂ ਜ਼ਿਆਦਾ ਜਲਦੀ ਲੱਭਣ ਦੀ ਕੋਸ਼ਿਸ਼ ਕਰਾਂਗੇ ਅਸੀਂ ਇਸ ਕੋਸ਼ਿਸ਼ ਵਿੱਚ ਰਹਾਂਗੇ ਕਿ ਤੁਹਾਡਾ ਬੈਗ ਅਸੀਂ ਫਟਾਫਟ ਲੱਭ ਸਕੀਏ ਅਤੇ ਧੰਨਵਾਦ ਪੰਜਾਬ ਪੁਲਿਸ ਨੂੰ ਦੱਸਣ ਲਈ ਅਤੇ ਆਪਣੀ ਕੰਮਪਲੇਟ ਕਰਨ ਲਈ ਧੰਨਵਾਦ ਓਕੇ